ਮੈਂ ਬੋਟਸ ਦਾ ਦਸ ਸਾਲ ਪਹਿਲਾਂ ਇ ਇੱਕ ਟਨ ਦਾ ਏ ਸੀ ਖਰੀਦਿਆ ਸੀ ਅਤੇ ਉਸਦੀ ਕੁਲਿੰਗ ਬਹੁਤ ਜ਼ਿਆਦਾ ਹੈ ਅਤੇ ਦਸ ਮਿੰਨਟ ਵਿੱਚ ਕਮਰਾ ਠੰਡਾ ਕਰ ਦਿੰਦਾ ਹੈ ਅਤੇ ਕੋਆਲਿਟੀ ਵੀ ਬਹੁਤ ਵਧੀਆ ਹੈ ਕੋਈ ਅੱਜ ਤੱਕ ਕੋਈ ਫ਼ਲਟ ਨਹੀਂ ਪਿਆ ਉਸ ਵਿੱਚ ਅਤੇ ਸਰਦੀਆਂ ਵਿੱਚ ਵੀ ਉਸਦਾ ਬਹੁਤ ਫ਼ਾਇਦਾ ਸਰਦੀਆਂ ਵਿੱਚ ਠੰਡ ਹੋਣ 'ਤੇ ਇਕਦਮ ਗਰਮੀ ਕਮਰੇ ਵਿੱਚ ਕਰ ਦਿੰਦਾ ਹੈ ਅਤੇ ਕੋਈ ਉਸ ਟਾਇਮ ਰੇਟ ਵੀ ਕੋਈ ਜ਼ਿਆਦਾ ਨਹੀਂ ਤਾਂ ਤੀਹ ਹਜਾਰ ਵਿੱਚ ਮੈਂ ਖਰੀਦਿਆ ਸੀ ਅਤੇ ਹੁਣ ਤਾਂ ਰੇਟ ਬਹੁਤ ਜ਼ਿਆਦਾ ਹੋ ਗਏ ਏ ਸੀ ਦੇ ਅਤੇ ਹੁਣ ਤੱਕ ਕੋਈ ਵੀ ਖਰਾਬੀ ਨਹੀਂ ਆਈ ਠੀਕ ਠਾਕ ਚੱਲ ਰਿਹਾ ਹੈ